ਵੱਖ ਵੱਖ ਮੌਸਮੀ ਸਥਿਤੀਆਂ ਵਿੱਚ ਦੌੜਨ ਲਈ ਕੁਝ ਹੇਠ ਲਿਖੇ ਸੁਝਾਓ ਦਿੱਤੇ ਹਨ ਗਰਮ ਮੌਸਮ ਸਵੇਰੇ ਜਾਂ ਸ਼ਾਮ ਨੂੰ ਦੌੜੋ ਦਿਨ ਵਿੱਚ ਸਭ ਤੋਂ ਗਰਮ ਸਮਾਂ ਦੁਪਹਿਰ ਦਾ ਹੁੰਦਾ ਹੈ ਇਸ ਲਈ ਸਵੇਰੇ ਜਾਂ ਸ਼ਾਮ ਨੂੰ ਦੌੜਨਾ ਬਿਹਤਰ ਹੁੰਦਾ ਹੈ ਜਦੋਂ ਤਾਪਮਾਨ ਘੱਟ ਹੁੰਦਾ ਹੈ ਨੰਬਰ ਦੋ ਪਾਣੀ ਜ਼ਰੂਰ ਪੀਓ ਦੌੜਨ ਤੋਂ ਪਹਿਲਾਂ ਦੌੜਨ ਦੇ ਸਮੇਂ ਅਤੇ ਦੌੜਨ ਤੋਂ ਬਾਅਦ ਪਾਣੀ ਜ਼ਰੂਰ ਪੀਓ ਨੰਬਰ ਤਿੰਨ ਹਲਕੇ ਕੱਪੜੇ ਪਹਿਨੋ ਸੂਤੀ ਜਾਂ ਨਾਈਲੋਨ ਵਰਗੇ ਹਲਕੇ ਕੱਪੜੇ ਪਹਿਨੋ ਜੋ ਪਸੀਨਾ ਸੋਖ ਲੈਣ ਨੰਬਰ ਤਿੰਨ ਸੂਰਜ ਦੀ ਰੋਸ਼ਨੀ ਤੋਂ ਬਚਾਅ ਕਰੋ ਸਕਿਨ ਕਰੀਮ ਲਗਾਓ ਅਤੇ ਟੋਪੀ ਪਹਿਨੋ ਠੰਢੇ ਸਥਾਨ 'ਤੇ ਦੌੜੋ ਜੇਕਰ ਸੰਭਵ ਹੋਵੇ ਤਾਂ ਛਾਂ ਵਿੱਚ ਜਾਂ ਏਅਰ ਕੰਡੀਸ਼ਨ ਜਗ੍ਹਾ ਵਿੱਚ ਦੌੜੋ ਠੰਢੇ ਮੌਸਮ ਲੇਅਰਡ ਕੱਪੜੇ ਪਹਿਨੋ ਕਈ ਪਰਤਾਂ ਵਿੱਚ ਕੱਪੜੇ ਪਹਿਨੋ ਤਾਂ ਜੋ ਤੁਸੀਂ ਜਿਵੇਂ ਜਿਵੇਂ ਗਰਮ ਹੋਂ ਕੱਪੜੇ ਉਤਾਰ ਸਕੋ ਸਿਰ ਅਤੇ ਹੱਥਾਂ ਨੂੰ ਢਕੋ ਟੋਪੀ ਜਸਤਾਨੇ ਅਤੇ ਸਕਾਪ ਪਹਿਨੋ ਵਾਮਅਪ ਕਰੋ ਦੌੜਨ ਤੋਂ ਪਹਿਲਾਂ ਹਮੇਸ਼ਾ ਵਰਿਆਮ ਅੱਪ ਕਰੋ ਸਾਹ ਦੀ ਕਸਰਤ ਕਰੋ ਠੰਢੀ ਹਵਾ ਵਿੱਚ ਸਾਹ ਲੈਣਾ ਔਖਾ ਹੋ ਸਕਦਾ ਹੈ ਇਸ ਲਈ ਸਾਹ ਦੀ ਕਸਰਤ ਕਰੋ ਹਾਈਡੇਟ ਕਰੋ ਮੌਸਮ ਨੂੰ ਵਿੱਚ ਪਾਣੀ ਪੀਣਾ ਜ਼ਰੂਰੀ ਰੱਖਣਾ ਚਾਹੀਦਾ ਹੈ ਬਰਸਾਤ ਵਾਟਰਪਰੂਫ ਜੁੱਤੀ ਅਤੇ ਕੱਪੜੇ ਪਹਿਨੋ ਵਾਟਰਪਰੂਫ ਕੱਪੜੇ ਪਹਿਨੋ ਜੁੱਤੀ ਜੈਕੇਟ ਪਹਿਨੋ ਸਾਵਧਾਨ ਰਹੋ ਗਿੱਲੀ ਸੜਕ 'ਤੇ ਦੌੜਦੇ ਸਮੇਂ ਸਾਵਧਾਨ ਰਹੋ ਕਿਉਂਕਿ ਇਹ ਫਿਸਲਣ ਵਾਲੀ ਹੋ ਸਕਦੀ ਹੈ ਜੇਕਰ ਤੁਸੀਂ ਰਾਤ ਨੂੰ ਦੌੜ ਰਹੇ ਹੋ ਤਾਂ ਰਿਫਐਕਟ ਕੱਪੜੇ ਪਹਿਨੋ ਦੌੜ ਨੂੰ ਰੋਕ ਦਿਓ ਜੇਕਰ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਤਾਂ ਦੌੜ ਨੂੰ ਰੋਕ ਦਿਓ ਸੁਝਾਅ ਕਦੇ ਕਦੇ ਇਕੱਲੇ ਨਾ ਦੌੜੋ ਹਮੇਸ਼ਾ ਕਿਸੇ ਦੋਸਤ ਜਾਂ ਪਰਿਵਾਰ ਮੈਂਬਰ ਦੀ ਨਾਲ ਦੌੜੋ ਆਪਣੇ ਆਸ ਪਾਸ ਦੇਖੋ ਆਪਣੇ ਆਸ ਪਾਸ ਦੇਖੋ ਅਤੇ ਆਵਾਜਾਈ ਅਤੇ ਹੋਰ ਖਤਰਿਆਂ ਤੋਂ ਸਾਵਧਾਨ ਰਹੋ ਆਪਣੇ ਫੋਨ ਨੂੰ ਆਪਣੇ ਨਾਲ ਲੈ ਜਾਓ ਐਮਰਜੈਂਸੀ ਵਿੱਚ ਤੁਹਾਨੂੰ ਕਿਸੇ ਦਾ ਫੋਨ ਕਰ ਸਕਦੇ ਹੋ ਆਪਣੀ ਸੀਮਾ ਨੂੰ ਜਾਣੋ ਆਪਣੀ ਸੀਮਾ ਨੂੰ ਜਾਣੋ ਅਤੇ ਜ਼ਿਆਦਾ ਦੌੜਨ ਦੀ ਕੋਸ਼ਿਸ਼ ਨਾ ਕਰੋ